ਹੈਲੋ ਹਾਂਜੀ ਹਾਂਜੀ ਗੁਰਪ੍ਰੀਤ ਹਾਂਜੀ ਮੈਮ ਜਿਹੜਾ ਤੁਸੀਂ ਔਡਰ ਭੇਜਿਆ ਸੀ ਸਾਨੂੰ ਟਾਈਮ ਸਿਰ ਮਿਲ ਗਿਆ ਹਾਂਜੀ ਹਾਂਜੀ ਅਸੀਂ ਨਾ ਤੁਹਾਡੇ ਐਪ ਤੋਂ ਜਿਹੜੀ ਵੀ ਕੋਈ ਚੀਜ਼ ਔਡਰ ਕਰਨੇ ਆ ਸਾਨੂੰ ਟਾਈਮ ਤੋਂ ਪਹਿਲਾਂ ਮਿਲ ਜਾਂਦੀ ਹੈ ਹਾਂਜੀ ਹਾਂਜੀ ਤੁਹਾਡੇ ਤੋਂ ਅਸੀਂ ਬਹੁਤ ਵਧੀਆ ਹੈ ਸਾਨੂੰ ਬਜ਼ਾਰ ਮਾਰਕੀਟ ਵਗੈਰਾ ਵੀ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਜਿਹੜਾ ਵੀ ਸਮਾਨ ਆ ਸਾਨੂੰ ਟਾਈਮ ਤੋਂ ਪਹਿਲਾਂ ਮਿਲ ਜਾਂਦਾ ਹਾਂਜੀ ਮੈਮ ਅਸੀਂ ਨਾ ਤੁਹਾਡੇ ਤੋਂ ਆਪਣੇ ਘਰ ਦੇ ਲਈ ਵੀ ਬਹੁਤ ਜ਼ਿਆਦਾ ਚੀਜ਼ਾਂ ਮੰਗਵਾਈਆਂ ਜਿੱਦਾਂ ਕਿ ਘਰ 'ਚ ਯੂਜ ਹੋਣ ਵਾਲੀਆਂ ਚੀਜ਼ਾਂ ਕੱਪੜੇ ਵਗੈਰਾ ਬਰਤਨ ਵਗੈਰਾ ਹਰ ਚੀਜ਼ ਮੰਗਵਾਈ ਆ ਉਹ ਸਾਨੂੰ ਟਾਈਮ ਤੋਂ ਪਹਿਲਾਂ ਮਿਲ ਰਹੀ ਆ ਤੁਹਾਡੇ ਤੋਂ ਹਾਂਜੀ ਹਾਂਜੀ ਤੁਹਾਡੇ ਐਪ 'ਤੇ ਸਾਨੂੰ ਵਧੀਆ ਪ੍ਰਾਈਜ਼ ਨਾਲ ਚੀਜ਼ ਮਿਲ ਰਹੀ ਹੈ ਜੀ ਨਹੀਂ ਜੀ ਨਹੀਂ ਜਿਹੜੀ ਤੁਹਾਡੀ ਕੋਈ ਵੀ ਚੀਜ਼ ਆਉਂਦੀ ਆ ਉਹਦੇ ਵਿੱਚ ਸਾਨੂੰ ਕਦੇ ਵੀ ਕੋਈ ਵੀ ਕੋਈ ਦਿੱਕਤ ਨਹੀਂ ਹੋਈ ਉਹ ਚੀਜ਼ ਸਾਨੂੰ ਟਾਈਮ ਤੋਂ ਪਹਿਲਾਂ ਅਤੇ ਵਧੀਆ ਮਿਲ ਜਾਂਦੀ ਠੀਕ ਆ ਜੀ ਬਹੁਤ ਵਧੀਆ ਸਰਵਿਸ ਹੈ ਜੀ ਤੁਹਾਡੀ ਸਾਨੂੰ ਅਗਰ ਕੋਈ ਜ਼ਰੂਰਤ ਪਈ ਅਸੀਂ ਦੁਬਾਰਾ ਵੀ ਤੁਹਾਡੇ ਤੋਂ ਹੀ ਚੀਜ਼ ਮੰਗਵਾਵਾਂਗੇ ਧੰਨਵਾਦ ਜੀ ਓਕੇ ਜੀ